ਪੰਜਾਬ ਵਿੱਚ ਮਹੱਤਵਪੂਰਨ ਮੰਦਰ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਹੈ ਪਟਿਆਲੇ ਦੇ ਵਿੱਚ ਸਾਡਾ ਸ਼ੀਸ਼ ਮਹਿਲ ਹੈ ਔਰ ਅਨੰਦਪੁਰ ਸਾਹਿਬ ਦੇ ਵਿੱਚ ਕਿਲ੍ਹਾ ਹੈ ਅਨੰਦਪੁਰ ਅਤੇ ਚਮਕੌਰ ਦੇ ਵਿੱਚ ਕਿਲ੍ਹਾ ਹੈ ਜਿਹਨੂੰ ਚਮ ਚਮਕੌਰ ਦੀ ਗੜ੍ਹੀ ਵੀ ਕਹਿੰਦੇ ਹਨ ਅਜਾਇਬ ਘਰ ਖਟਖੜ ਕਲਾਂ ਦੇ ਵਿੱਚ ਹੈ ਜੋ ਕਿ ਇਹ ਸਾਡੇ ਸਾਰੇ ਇਤਿਹਾਸ ਦੇ ਨਾਲ ਜੋੜਦੇ ਹਨ